ਹਸਪਤਾਲ ਪ੍ਰਬੰਧਨ ਦਾ ਬਹੁਤ ਮਾੜਾ ਹਾਲ ਹੈ ਅਤੇ ਹਸਪਤਾਲਾਂ ਵਿੱਚ ਇਲਾਜ ਕਰਾਉਣਾ ਬਹੁਤ ਮੁਸ਼ਕਿਲ ਹੈ ਸਰਕਾਰੀ ਹਸਪਤਾਲਾਂ ਵਿੱਚ ਜਦੋਂ ਜਾਂਦੇ ਹਾਂ ਤਾਂ ਪਹਿਲਾਂ ਪਰਚੀ ਕਟਵਾਉਣ ਵਾਸਤੇ ਕਾਫ਼ੀ ਵੱਡੀ ਲਾਈਨ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਲਾਈਨ ਵਿੱਚ ਖੜੇ ਰਹਿ ਕੇ ਹੀ ਕਾਫ਼ੀ ਮਰੀਜ਼ ਜ਼ਿਆਦਾ ਬੀਮਾਰ ਹੋ ਜਾਂਦੇ ਹਨ ਪਰਚੀ ਕਟਵਾਉਣ ਤੋਂ ਬਾਅਦ ਡਾਕਟਰ ਕੋਲ ਜਾਓ ਅਤੇ ਡਾਕਟਰ ਚੈੱਕਅੱਪ ਹੋਰ ਲਿੱਖ ਦਿੰਦਾ ਹੈ ਟੈਸਟ ਲਿਖ ਦਿੰਦਾ ਹੈ ਜਿਨ੍ਹਾਂ ਟੈਸਟਾਂ ਵਿੱਚ ਸਾਨੂੰ ਬਾਹਰ ਜਾ ਕੇ ਟੈਸਟ ਕਰਵਾਉਣੇ ਪੈਂਦੇ ਹਨ ਜਦੋਂ ਟੈਸਟ ਕਰਵਾਕੇ ਆਉਂਦੇ ਹਾਂ ਤਾਂ ਡਾਕਟਰ ਛੁੱਟੀ ਪਰ ਚਲੇ ਜਾਂਦਾ ਹੈ ਜਾਂ ਓਪਰੇਸ਼ਨ 'ਤੇ ਚਲੇ ਜਾਂਦਾ ਹੈ ਜਿਸ ਵਜ੍ਹਾ ਨਾਲ਼ ਮਰੀਜ਼ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ ਜਦੋਂ ਡਾਕਟਰ ਆਉਂਦਾ ਹੈ ਤਾਂ ਛੁੱਟੀ ਦਾ ਟਾਈਮ ਹੋ ਜਾਂਦਾ ਹੈ ਅਖੀਰ ਪੇਸ਼ੈਂਟ ਨੂੰ ਇਹ ਰਿਪੋਰਟਾਂ ਲੈ ਕੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ ਪ੍ਰਾਈਵੇਟ ਹਸਪਤਾਲਾਂ ਵਿੱਚ ਬਹੁਤ ਹੀ ਜ਼ਿਆਦਾ ਪੈਸੇ ਲੱਗਦੇ ਹਨ ਬਹੁਤ ਹੀ ਮਹਿੰਗਾ ਇਲਾਜ ਹੁੰਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਪੰ ਪੰਜਾਬ ਦੇ ਜਿੰਨੇ ਵੀ ਸਰਕਾਰੀ ਹਸਪਤਾਲ ਹਨ ਉਹਨਾਂ ਵਿੱਚ ਡੋਕਟਰਾਂ ਦਾ ਬੈਠਣਾ ਸਹੀ ਟਾਈਮ ਦਿੱਤਾ ਜਾਏ ਡਾਕਟਰਾਂ ਨੂੰ ਸਹੀ ਟਾਈਮ ਦਿੱਤਾ ਜਾਏ ਜਿਸ ਨਾਲ਼ ਸਹੀ ਇਲਾਜ ਹੋ ਸਕੇ ਹਸਪਤਾਲਾਂ ਵਿੱਚ ਲੱਗੇ ਹੋਏ ਪੱਖੇ ਬੈੱਡ ਜੋ ਕਿ ਕਾਫ਼ੀ ਮੁਰੰਮਤਯੋਗ ਹਨ ਉਹਨਾਂ ਨੂੰ ਵਧੀਆ ਤਰੀਕੇ ਨਾਲ਼ ਮੁਰੰਮਤ ਕਰਵਾਉਣ ਲਈ ਕਿਸੇ ਠੇਕੇਦਾਰ ਨੂੰ ਰੱਖਣਾ ਚਾਹੀਦਾ ਹੈ ਜੋ ਸਫਾਈ ਸੇਵਾਦਾਰ ਹਨ ਉਹਨਾਂ ਨੂੰ ਸਫਾਈ ਦਾ ਪੂਰਾ ਧਿਆਨ ਰੱਖਣਾ ਵਾਸਤੇ ਆਖਣਾ ਚਾਹੀਦਾ ਹੈ ਕਿ ਵਧੀਆ ਤਰੀਕੇ ਨਾਲ਼ ਸਫਾਈ ਕਰੋ ਅਤੇ ਮਰੀਜ਼ਾਂ ਦੀ ਦੇਖਭਾਲ ਕਰੋ ਇਹ ਸਭ ਗੱਲਾਂ ਸਰਕਾਰ ਨੂੰ ਚਾਹੀਦੀਆਂ ਹਨ ਕਿ ਇਹਨਾਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਵਾ ਸਕੇ